ਜਿਵੇਂ ਸੋਕੇ ਦੇ ਮੌਸਮ ਦੇ ਵਿੱਚ ਆਪਾਂ ਬੂਟੇ ਲਾਏ ਆ ਚਾਹੇ ਗਮਲਿਆਂ ਦੇ ਵਿੱਚ ਹੋਣੇ ਚਾਹੇ ਕਿਆਰੀ ਦੇ ਵਿੱਚ ਹੋਣ ਚਾਹੇ ਕੋਈ ਸਬਜ਼ੀ ਦਾ ਬੂਟਾ ਹੈ ਚਾਹੇ ਫਲਦਾਰ ਬੂਟਾ ਹੈ ਜਿਵੇਂ ਕਿ ਸਬਜ਼ੀ ਦੇ ਰਿਗਾਰਡਿੰਗ ਹਰੀਆਂ ਮਿਰਚਾਂ ਵਗੈਰਾ ਹੈ ਤਾਂ ਇਹਨਾਂ ਨੂੰ ਸੋਕਾ ਜਿਹੜਾ ਮਾਰ ਕਰਦਾ ਹੈ ਅਤੇ ਉਹਦੇ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਹੈ ਓਹ ਅਤੇ ਨੰਬਰ ਦੋ 'ਤੇ ਫਿਰ ਬਰਸਾਤ ਆ ਜਾਂਦੀ ਹੈ ਬਰਸਾਤ ਦੇ ਮੌਸਮ ਦੇ ਵਿੱਚ ਇਹ ਜਿਹੜੇ ਬੂਟੇ ਇਹਨਾਂ ਨੂੰ ਮੱਛਰ ਵਗੈਰਾ ਬਹੁਤ ਮਾਰ ਕਰਦਾ ਉਹਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੈ ਜੇ ਕਈ ਵਾਰ ਤਾਂ ਸਪਰੇਅ ਵੀ ਕਰਨੀ ਪੈਂਦੀ ਹੈ ਉਹ ਮੱਛਰ ਇਹਦਾਂ ਦੇ ਪੱਤਿਆਂ ਨੂੰ ਖਾ ਜਾਂਦਾ ਹੈ ਫਿਰ ਉਹਦੇ ਬਾਅਦ ਇੱਥੇ ਫਲ਼ ਦੇ ਵਿੱਚ ਅਸਰ ਪੈਂਦਾ ਬਾਕੀ ਗੱਲ ਰਹਿ ਗਈ ਸਰਦੀਆਂ ਦੀ ਸਰਦੀਆਂ ਦੇ ਵਿੱਚ ਇਹਨਾਂ ਬੂਟਿਆਂ ਨੂੰ ਜਿਵੇਂ ਕੋਰਾ ਪੈਂਦਾ ਪੋਹ ਦੇ ਮਹੀਨੇ ਦਸੰਬਰ ਦੇ ਮਹੀਨੇ ਜੋ ਕੋਰਾ ਪੈਂਦਾ ਕੋਰੇ ਦੇ ਨਾਲ਼ ਇਹਨਾਂ ਦਰਖਤਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਪਿੰਡਾਂ ਵਿੱਚ ਤਾਂ ਆਪਾਂ ਇਹਨਾਂ ਦੀ ਸਭ ਸਾਂਭ ਸੰਭਾਲ ਲਈ ਪਰਾਲ਼ੀ ਵਗੈਰਾ ਉੱਪਰ ਪਾ ਦਿੰਦੇ ਹੈ ਪਰ ਸ਼ਹਿਰਾਂ ਦੇ ਵਿੱਚ ਪਰਾਲ਼ੀ ਪਰੂਲੀ ਤਾਂ ਇੱਥੇ ਨਹੀਂ ਮਿਲਦੀ ਅਤੇ ਆਪਾਂ ਇੱਕ ਹਰਾ ਕੱਪੜਾ ਵਗੈਰਾ ਉਹਦੇ ਨਾਲ਼ ਇਹਨਾਂ ਨੂੰ ਬਚਾਉਣ ਖਾਤਰ ਜਾਂ ਜਿਵੇਂ ਕੋਈ ਸਾਡਾ ਬਰਾਂਡਾ ਬਰਾਂਡੇ ਦੇ ਵਿੱਚ ਰੱਖ ਕੇ ਇਹਨਾਂ ਦੀ ਸਭ ਸਾਂਭ ਸੰਭਾਲ ਕਰ ਲੈਂਦੇ ਹਾਂ ਅਤੇ ਪਾਣੀ ਤਾਂ ਇਹਨਾਂ ਨੂੰ ਨ ਆਪਣਾ ਸਰਦੀਆਂ 'ਚ ਵੀ ਦੇਣਾ ਪੈਂਦਾ ਪਰ ਥੋੜ੍ਹਾ ਦੇਣਾ ਆਪਾਂ ਜਿਹੜਾ ਇਹਨਾਂ ਵਿੱਚ ਖੜ੍ਹੇ ਨਾ ਕਿਉਂ ਜੇ ਪਾਣੀ ਆਪਾਂ ਖੜ੍ਹਾ ਰੱਖਾਂਗੇ ਉਹਦੇ ਵਿੱਚ ਮੱਛਰ ਦਾ ਜ਼ਿਆਦਾ ਪੈਦਾ ਹੋ ਜਾਂਦਾ ਅਤੇ ਦੂਜੀ ਗੱਲ ਹੋ ਗਈ ਪੱਤਝੜ ਦੇ ਦਿਨਾਂ ਵਿੱਚ ਪੱਤਝੜ ਦੇ ਦਿਨਾਂ ਵਿੱਚ ਪੱਤੇ ਬਹੁਤ ਹੇਠਾਂ ਗਿਰ ਜਾਂਦੇ ਆ ਚਲੋ ਗਿਰਨਾ ਹੀ ਹੈ ਪੱਤਿਆਂ ਨੇ ਸਾਲ ਦੇ ਵਿੱਚ ਇੱਕ ਪ ਵਾਰੀ ਪੱਤਝੜ ਆਉਂਦੀ ਹੈ ਜਿਵੇਂ ਸਾਹਮਣੇ ਪਾਰਕ ਦੇ ਵਿੱਚ ਦਰੱਖਤ ਖੜ੍ਹੇ ਹੈ ਉਹਨਾਂ ਦੇ ਵਿੱਚ ਪਾਣੀ ਪਾਉਣ ਖਾਤਰ ਉਹਨੂੰ ਆਲ਼ੇ ਦੁਆਲ਼ੇ ਡੋਲ਼ ਵਗੈਰਾ ਰੱਖਣੀ ਪੈਂਦੀ ਹੈ ਪਾਣੀ ਅ ਸੁਬਹਾ ਸ਼ਾਮ ਜਦੋਂ ਵੀ ਟਾਈਮ ਲੱਗਦਾ ਪਾ ਦੇਣਾ ਚਾਹੀਦਾ ਕਿਉਂ ਪੱਤਝੜ ਦੇ ਟਾਈਮ ਹਰੇ ਪੱਤੇ ਨਿਕਲਦੇ ਆ ਉਹਨਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਅਤੇ ਦਰੱਖਤ ਸਾਡੀ ਸਿਹਤ ਸੰਭਾਲ ਲਈ ਬਹੁਤ ਜ਼ਰੂਰੀ ਹੈ ਵਾਤਾਵਰਨ ਨੂੰ ਬਹੁਤ ਵਧੀਆ ਰੱਖਦੇ